ਮੈਨੂੰ ਸ਼ੁਰੂ ਤੋਂ ਹੀ ਡਿਜ਼ਾਈਨਿੰਗ ਦਾ ਬਹੁਤ ਸ਼ੌਂਕ ਹੈ ਜਦੋਂ ਮੈਂ ਡਿਜ਼ਾਈਨਿੰਗ ਕਰਦੀ ਹੁੰਦੀ ਸੀਗੀ ਅਤੇ ਸਾਨੂੰ ਲਾਈਵ ਮੋਡਲ ਦਿੱਤੇ ਜਾਂਦੇ ਸੀਗੇ ਲਾਈਵ ਮੋਡਲ ਬਣਾਉਣ ਲੱਗਿਆਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਸੀਗਾ ਕਿ ਜਿਹੜੀ ਚੀਜ਼ ਸਾਨੂੰ ਦਿੱਤੀ ਗਈ ਹੈ ਉਸਦਾ ਅਸੀਂ ਉਸ ਤੋਂ ਕਿੰਨੀ ਦੂਰੀ 'ਤੇ ਬੈਠੇ ਹਾਂ ਉਸ ਦੂਰੀ ਤੋਂ ਸਾਨੂੰ ਉਸਦਾ ਕਿੰਨਾਂ ਸਾਈਜ਼ ਕਲਰ ਔਰ ਉਹਦੀ ਸ਼ੇਡ ਕਿੰਨੀ ਦਿੱਖ ਰਹੀ ਹੈ ਜਿਸ ਤਰਫ ਉਹਦੀ ਸ਼ੇਡ ਜਾ ਰਹੀ ਹੈ ਉਸ ਤਰਫ ਬਣ ਰਹੀ ਹੈ ਔਰ ਉੱਥੇ ਹੀ ਉਹ ਚੈੱਕ ਕੀਤਾ ਜਾਂਦਾ ਸੀਗਾ ਕਿ ਹਾਂ ਕਿ ਐਕਚੁਅਲ ਉਹਦਾ ਸਾਈਜ਼ ਉਨਾਂ ਹੀ ਹੈ ਕਿ ਜਿੰਨਾਂ ਇਹਨਾਂ ਨੂੰ ਦਿਖ ਰਿਹਾ ਹੈ ਸਿਰਫ ਇਸ ਚੀਜ਼ ਦੀ ਮੁਸ਼ਕਿਲ ਹੁੰਦੀ ਹੈ ਕਿ ਅਗਰ ਉਹਦਾ ਸਾਈਜ਼ ਵੱਡਾ ਜਾ ਛੋਟਾ ਹੋ ਜਾਣਾ ਉਸਦੀ ਬਨਾਵਟ ਵਿੱਚ ਫਰਕ ਆ ਜਾਣਾ ਇਹ ਚੀਜ਼ ਦੀ ਮੁਸ਼ਕਿਲ ਹੁੰਦੀ ਸੀਗੀ